ਸਾਡੇ ਦੇਸ ਦੇ ਅਜ਼ਾਦੀ ਦੇ ਲਈ ਸਹੀ ਬਹੁਤ ਸਾਰੇ ਸ਼ਹੀਦਾਂ ਨੇ ਸ਼ਹੀਦੀ ਦਿੱਤੀ ਉਹਨਾਂ ਦੇ ਵਿੱਚੋਂ ਸ਼ਹੀਦ ਭਗਤ ਸਿੰਘ ਜੀ ਇੱਕ ਹਨ ਜਿਹਨਾਂ ਨੇ ਛੋਟੀ ਉਮਰ ਦੇ ਵਿੱਚ ਆਪਣਾ ਜਮ ਜਾਨ ਗਵਾ ਦਿੱਤਾ ਸਾਡੇ ਦੇਸ ਦੇ ਅਜ਼ਾਦੀ ਦੇ ਲਈ ਅਤੇ ਬਹੁਤ ਸਾਰੇ ਨੇਤਾ ਵੀ ਹਨ ਜਿਹੜੇ ਮਤਲਬ ਜਿਵੇਂ ਹੋ ਗਿਆ ਜਵਾਹਰ ਲਾਲ ਨਹਿਰੂ ਉਹ ਉਹਨਾਂ ਨੇ ਵੀ ਦੇਸ ਦੀ ਅਜ਼ਾਦੀ ਦੇ ਲਈ ਆਪਣਾ ਮਤਲਬ ਆਪਣਾ ਜਾਨ ਗਵਾ ਦਿੱਤਾ ਅਤੇ ਸਾਡੇ ਦੇਸ ਦੇ ਵਿੱਚ ਛੱਬੀ ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਜਿਸ ਦੇ ਵਿੱਚ ਮਤਲਬ ਸਾਡਾ ਦੇਸ ਮਲਬ ਅੰਗਰੇਜ਼ਾਂ ਤੋਂ ਮੁਕਤ ਹੋਇਆ ਅਸੀਂ ਮਤਲਬ ਬਚਪਨ ਤੋਂ ਹੀ ਸਕੂਲਾਂ 'ਚ ਸਾਨੂੰ ਪੜ੍ਹਾਇਆ ਗਿਆ ਹੈ ਅਤੇ ਉਨ੍ਹਾਂ ਟੀਚਰਾਂ ਨੇ ਦੱਸਿਆਂ ਹੋਇਆ ਕਿ ਮਤਲਬ ਸਾਡੇ ਦੇਸ਼ ਕਿਵੇਂ ਅਜ਼ਾਦ ਹੋਇਆ ਕਿਹਨਾਂ ਕਿਹਨਾਂ ਨੇ ਕੁਰਬਾਨੀਆਂ ਦਿੱਤੀ ਮਤਲਬ ਅਤੇ ਕਿ ਕਿਹੜੇ ਕਿਹੜੇ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਅਤੇ ਸਾਨੂੰ ਮਤਲਬ ਇਹ ਦੇ ਬਾਰੇ ਮਤਲਬ ਸਾਨੂੰ ਛੋਟੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਹੈ ਅਤੇ ਦੇਸ ਦੇ ਬਾਰੇ ਮਤਲਬ ਪਤਾ ਲੱਗਣਾ ਚਾਹੀਦਾ ਹੈ ਕਿ ਕਿਆ ਹੋਇਆ ਸਾਡੇ ਦੇਸ 'ਤੇ ਕਿਆ ਨਹੀਂ ਹੋਇਆ